ਵਿਆਹ ਵੀ ਹਰ ਘਰ ਦੇ ਵਿੱਚ ਹੁੰਦਾ ਹੈ ਸਮਾਗਮ ਵੀ ਹਰ ਘਰ ਦੇ ਵਿੱਚ ਹੁੰਦਾ ਹੈ ਸਾਨੂੰ ਪਾਣੀ ਬਹੁਤ ਹੀ ਸੋਚ ਸਮਝ ਕੇ ਵਰਤਣਾ ਚਾਹੀਦਾ ਹੈ ਪਾਣੀ ਦੀ ਟੈਂਕੀ ਫੁਲ ਕਰਕੇ ਰੱਖਣੀ ਚਾਹੀਦੀ ਹੈ ਅਤੇ ਉਸਨੂੰ ਵਾਰ ਵਾਰ ਦੇਖਣਾ ਚਾਹੀਦਾ ਹੈ ਪਾਣੀ ਦੀਆਂ ਪੇਟੀਆਂ ਲੋੜ ਤੋਂ ਵੱਧ ਲਿਆ ਕੇ ਰੱਖਣੀਆਂ ਚਾਹੀਦੀਆਂ ਹਨ ਕਿ ਕੋਈ ਵੀ ਵਿਆਹ ਸਮਾਗਮ ਦੌਰਾਨ ਪਾਣੀ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਇਸ ਲਈ ਪਾਣੀ ਦੀ ਵਰਤੋਂ ਸਾਨੂੰ ਸੋਚ ਸਮਝ ਕੇ ਕਰਨੀ ਚਾਹੀਦੀ ਹੈ